ਸਰ ਮੇਰਾ ਨਾਮ ਭਾਰਤ ਵਿਸ਼ਵ ਪਿੰਡ ਮਿਰਜਾਪੁਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਅਤੇ ਜੇਕਰ ਗੱਲ ਕਰੀਏ ਸ਼ਿਲਪਕਾਰੀ ਦੀ ਸ਼ਿਲਪਕਾਰੀ ਸਾਡੇ ਇਲਾਕੇ ਵਿੱਚ ਕਾਫੀ ਜ਼ਿਆਦਾ ਕੀਤੀ ਜਾਂਦੀ ਹੈ ਜਿੱਦਾਂ ਮੰਦਰਾਂ ਦੇ ਵਿੱਚ ਮੂਰਤੀਆਂ ਅਤੇ ਨਾਲ ਦੀ ਨਾਲ ਹਰ ਚੌਂਕ ਦੇ ਵਿੱਚ ਕਿਸੇ ਨਾ ਕਿਸੇ ਸ਼ਹੀਦ ਦੀ ਜਾਂ ਕਿਸੇ ਨਾ ਕਿਸੇ ਰਾਸ਼ਟਰੀ ਰਹੇ ਹੋਏ ਸਾਡੇ ਪ੍ਰਧਾਨ ਮੰਤਰੀ ਜਾਂ ਸਾਡੇ ਰਹੇ ਹੋਏ ਸਾਡੇ ਰਾਸ਼ਟਰਪਤੀਆਂ ਦੀ ਫੋਟੋਆਂ ਬਣੀਆਂ ਹੁੰਦੀਆਂ ਹਨ ਅਕਸਰ ਦੇਖੀਆਂ ਗਈਆਂ ਅਤੇ ਜੇਕਰ ਗੱਲ ਕਰੀਏ ਪੰਜਾਬ ਦੇ ਸੱਭਿਆਚਾਰ ਦੀ ਸੱਭਿਆਚਾਰ ਨੂੰ ਦਰਸਾਉਣ ਲਈ ਭੰਗੜਾ ਪਾਉਂਦੇ ਸਾਡੇ ਨੌਜਵਾਨ ਅਤੇ ਗਿੱਧਾ ਪਾਉਂਦੀਆਂ ਸਾਡੀਆਂ ਨੌਜਵਾਨ ਭੈਣਾਂ ਅਤੇ ਕਾਫੀ ਹੱਦ ਤੱਕ ਦੇਖਿਆ ਗਿਆ ਚਰਖੇ ਦੇ ਉੱਤੇ ਗਿੱਧਾ ਪਾਉਂਦੇ ਜਿੰਨੇ ਵੀ ਔਜ਼ਾਰ ਹਨ ਉਹ ਸਾਰੇ ਹੀ ਸ਼ੋ ਕੀਤੇ ਹੁੰਦੇ ਆ ਬਹੁਤ ਵਧੀਆ ਲੱਗਦਾ ਬਹੁਤ ਸੋਹਣਾ ਵੀ ਲੱਗਦਾ ਦੇਖਣ ਨੂੰ ਸਾਡੇ ਪੰਜਾਬ ਵਾਸਤੇ ਮਾਣ ਦੀ ਗੱਲ ਆ ਕਿ ਹਰ ਇੱਕ ਚੀਜ਼ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦਰਸਾਇਆ ਗਿਆ ਹੁੰਦਾ ਅਤੇ ਇਹਦੇ ਵਿੱਚ ਸਾਡੇ ਮਧਾਣੀਆਂ ਸਾਡੇ ਪੁਰਾਣੇ ਵਰਤੇ ਗਏ ਸੰਦ ਜਿੱਦਾਂ ਹੱਲਾਂ ਕਹੀਆਂ ਗੈਤੀਆਂ ਇਹ ਦਾਤਰੀਆਂ ਰੰਬੇ ਅਤੇ ਬਹੁਤ ਵਧੀਆ ਤਰੀਕੇ ਨਾਲ ਸ਼ਿਲਪ ਕਰਕੇ ਸਾਨੂੰ ਦਰਸਾਏ ਗਏ ਹੁੰਦੇ ਹਨ ਅਤੇ ਬਹੁਤ ਵਧੀਆ ਸੁਚੱਜੇ ਢੰਗ ਨਾਲ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਅਤੇ ਬਹੁਤ ਵਧੀਆ ਲੱਗਦਾ ਸਾਨੂੰ ਕਿ ਇਹ ਚੀਜ਼ਾਂ ਸਾਡੇ ਆਉਣ ਵਾਲੀ ਪੀੜੀ ਵੀ ਦੇਖਣ ਨੂੰ ਦੇਖ ਸਕਦੀ ਆ ਬਹੁਤ ਵਧੀਆ ਲੱਗਦਾ ਜੀ ਅਤੇ ਜੇਕਰ ਸਾਡੇ ਜੇਕਰ ਸਾਡੇ ਚੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਜਿੱਦਾਂ ਸਿਪਾਹੀ ਚੌਂਕ ਹੋਏ ਉੱਥੇ ਸ਼ਹੀਦ ਦੀ ਫੋਟੋ ਲਗਾਈ ਹੁੰਦੀ ਹੈ ਜਿੱਦਾਂ ਚੌਂਕ ਪਟੇਲ ਚੌਂਕ ਆ ਉੱਥੇ ਭੀਮ ਰਾਏ ਪੰਧੇਰ ਦੀ ਫੋਟੋ ਲਗਾਈ ਹੁੰਦੀ ਹੈ ਜੇ ਸ਼ਹੀਦਾਂ ਦੀ ਗੱਲ ਕੀਤੀ ਜਾਵੇ ਭਗਤ ਸਿੰਘ ਚੌਂਕ ਦੇ ਵਿੱਚ ਭਗਤ ਸਿੰਘ ਦੀ ਫੋਟੋ ਲਗਾਈ ਹੁੰਦੀ ਆ ਗਾਂਧੀ ਚੌਂਕ ਦੇ ਵਿੱਚ ਸ਼੍ਰੀ ਸਾਡੇ ਮਹਾਤਮਾ ਗਾਂਧੀ ਜੀ ਉਹਨਾਂ ਦੀ ਫੋਟੋ ਲਗਾਈ ਹੁੰਦੀ ਆ ਕਾਫੀ ਹੱਦ ਤੱਕ ਦੇਖਿਆ ਗਿਆ ਕਿ ਸਾਰੀਆਂ ਸ਼ਿਲਪਕਾਰ ਇੱਦਾਂ ਦੀਆਂ ਹੀ ਫੋਟੋਆਂ ਲਗਾਉਂਦੇ ਆ ਜਿੱਦਾਂ ਜਿਸ ਦੇ ਨਾਂ 'ਤੇ ਚੌਂਕ ਹੋਵੇ ਉਸੇ ਨਾਂ ਉਸੇ ਹੀ ਬੰਦੇ ਦੀ ਉਸੇ ਹੀ ਪਰਸਨ ਦੀ ਫੋਟੋ ਸ਼ਿਲਪ ਕਰਕੇ ਉੱਥੇ ਲਗਾਈ ਗਈ ਹੁੰਦੀ ਆ ਬਹੁਤ ਵਧੀਆ ਲੱਗਦਾ ਜੀ ਧੰਨਵਾਦ ਜੀ